ਪੰਜਾਬ ਵਿੱਚ ਟੈਕਨੋਲਜੀ ਸੈਕਟਰ ਚੁਣੌਤੀਆਂ ਜਾਂ ਰੁਕਾਵਟਾਂ ਨਾਲ ਨਜਿੱਠਣ ਵਾਸਤੇ ਨਵੇਂ ਨਵੇਂ ਤਰੀਕੇ ਅਪਣਾ ਰਿਹਾ ਹੈ ਖੇਤੀਬਾੜੀ ਵਿੱਚ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਨੂੰ ਘਟਾਉਣ ਲਈ ਨਵੀਨੀਕਰਨ ਯੋਗ ਊਰਜਾ ਸਮਾਰਟ ਇਰੀਗੇਸ਼ਨ ਅਤੇ ਆਰਟੀਫਿਸ਼ਅਲ ਇੰਟੈਲੀਜੈਂਸ ਨੂੰ ਅਪਣਾਇਆ ਜਾ ਰਿਹਾ ਹੈ ਡਰੋਨ ਟਕਨੀਕ ਦੀ ਮਦਦ ਨਾਲ ਖੇਤਾਂ ਦੀ ਨਿਗਰਾਨੀ ਕੀਤੀ ਜਾਂਦੀ ਹੈ ਜਿੱਥੇ ਇਹ ਮਿੱਟੀ ਦੀ ਗੁਣਵੱਤਾ ਫਸਲਾਂ ਦੀ ਹਾਲਤ ਅਤੇ ਕੀੜਿਆਂ ਦੀ ਸ਼ਨਾਖਤ ਵਿੱਚ ਮਦਦ ਕਰਦੀ ਹੈ ਜੀ ਆਈ ਐਸ ਮੈਪਿੰਗ ਰਾਹੀਂ ਜ਼ਮੀਨ ਦੀ ਉਪਜਾਊ ਸ਼ਕਤੀ ਦੀ ਜਾਂਚ ਕੀਤੀ ਜਾਂਦੀ ਹੈ ਜੇ ਇਸ ਨਾਲ ਕਿਸਾਨ ਸੋਚ ਸਮਝ ਕੇ ਖਾਦ ਅਤੇ ਪਾਣੀ ਦੀ ਵਰਤੋਂ ਕਰ ਸਕੇ ਸਮਾਰਟ ਮੋਬਾਈਲ ਐਪਸ ਅਤੇ ਓਨਲਾਈਨ ਕ੍ਰਿਸ਼ੀ ਮਾਰਕੀਟ ਪਲੇਟਫਾਰਮ ਕਿਸਾਨਾਂ ਨੂੰ ਨਵੇਂ ਪੈਦਾਵਾਰ ਤਰੀਕਿਆਂ ਦੀ ਜਾਣਕਾਰੀ ਦਿੰਦਾ ਹੈ ਕੁਦਰਤੀ ਆਫਤਾਂ ਲਈ ਪੰਜਾਬ ਵਿੱਚ ਹੜ੍ਹ ਸੋਕਾ ਪੈਣਾ ਅਤੇ ਭੂਚਾਲ ਵਰਗੀਆਂ ਆਫਤਾਂ ਇੱਕ ਵੱਡੀ ਚੁਣੌਤੀ ਹਨ ਜਿਸ ਲਈ ਇਹ ਡਰੋਨ ਜੀ ਆਈ ਐਸ ਮੈਪਿੰਗ ਅਤੇ ਆਟੋਮੈਟਿਕ ਵੈਦਰਿੰਗ ਅਲਰਟ ਸਿਸਟਮ ਸ਼ਾਮਲ ਹਨ ਜੋ ਕਿ ਆਉਣ ਵਾਲੀਆਂ ਆਫਤਾਂ ਦੀ ਭਵਿੱਖਬਾਣੀ ਅਤੇ ਪ੍ਰਭਾਵਿਤ ਖੇਤਰਾਂ ਦੀ ਪਛਾਣ ਕਰਦੇ ਹਨ ਸੈਟਾਲਾਈਟ ਡਾਟਾ ਰਾਹੀਂ ਹੜ੍ਹ ਆਉਣ ਤੋਂ ਪਹਿਲਾਂ ਹੀ ਜਲ ਪੱਧਰ ਅਤੇ ਨਦੀ ਪ੍ਰਵਾਹ ਹੀ ਜਾਣਕਾਰੀ ਦਿੱਤੀ ਜਾਂਦੀ ਹੈ ਜਿਸ ਨਾਲ ਸਰਕਾਰ ਅਤੇ ਰਾਹਤ ਸੰਸਥਾਵਾਂ ਤੁਰੰਤ ਕਾਰਵਾਈ ਕਰ ਸਕਣ ਜਨਤਕ ਸੁਰੱਖਿਆ ਲਈ ਪੰਜਾਬ ਵਿੱਚ ਆਧੁਨਿਕ ਨਿਗਰਾਨੀ ਅਤੇ ਸੁਰੱਖਿਆ ਤਕਨੀਕਾਂ ਦੀ ਵਰਤੋਂ ਕਰਕੇ ਅਪਰਾਧ ਅਤੇ ਟ੍ਰੈਫਿਕ ਮੈਨੇਜਮੈਂਟ ਵਿੱਚ ਸੁਧਾਰ ਲਿਆਇਆ ਗਿਆ ਹੈ ਸੀ ਸੀ ਟੀ ਵੀ ਕੈਮਰੇ ਆਰਟੀਫਿਸ਼ਅਲ ਇੰਟੈਲੀਜੈਂਸ ਅਤੇ ਸਮਾਰਟ ਟਰੈਫਿਕ ਲਾਈਟਸ ਵੱਡੇ ਸ਼ਹਿਰਾਂ ਵਿੱਚ ਲਾਗੂ ਕੀਤੀਆਂ ਗਈਆਂ ਹਨ ਫੇਸ ਰਿਕੋਗਨਾਈਜੇਸ਼ਨ ਅਤੇ ਵਾਹਨ ਨੰਬਰ ਪਲੇਟ ਪਛਾਣ ਤਕਨੀਕ ਰਾਹੀਂ ਸ਼ਖਸੀਅਤ ਨੋਟਿਸ ਅਤੇ ਅਪਰਾਧੀਆਂ ਦੀ ਪਛਾਣ ਆਸਾਨ ਹੋ ਰਹੀ ਹੈ ਡਰੋਨ ਅਤੇ ਜੀ ਪੀ ਐਸ ਟਰੈਕਿੰਗ ਦੀ ਵਰਤੋਂ ਕਰਕੇ ਇਹ ਵੱਡੇ ਇਲਾਕਿਆਂ ਵਿੱਚ ਨਿਗਰਾਨੀ ਅਤੇ ਰੀਅਲ ਟਾਈਮ ਕਾਰਵਾਈ ਯਕੀਨੀ ਬਣਾਈ ਜਾ ਰਹੀ ਹੈ ਇਸ ਤਰ੍ਹਾਂ ਪੰਜਾਬ ਤਕਨੀਕੀ ਦੇ ਮੈਦਾਨ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ